ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਹਾਂਜੀ ਕਿਵੇਂ ਫੋਨ ਕੀਤਾ ਵੀਰੇ ਹਾਂਜੀ ਹਾਂਜੀ ਪੇਂ ਪੇਂਟਰ ਅਕਾਸ਼ ਕਿਹੜਾ ਪਿੰਡ ਵੀਰੇ ਬਾਲੀਆਲ ਅੱਛਾ ਅੱਛਾ ਠੀਕ ਹੈ ਜੀ ਅੱਛਾ ਹਾਂਜੀ ਉਹ ਦੇਖਣਾ ਪੈਣਾ ਉੱਥੇ ਆ ਕੇ ਚੈੱਕ ਕਰਨਾ ਪੈਣਾ ਪੀ ਓ ਪੀ ਕਰਾਇਆ ਸੀ ਕਿ ਦੂਜਾ ਕਰਾਇਆ ਅੱਛਾ ਠੀਕ ਹੈ ਜੀ ਆਹ ਹਾਂਜੀ ਕੋਈ ਨਾ ਉਤਾਰ ਕੇ ਨਵਾਂ ਚੜ੍ਹਾ ਦਿਆਂਗੇ ਕੋਈ ਗੱਲ ਨਹੀਂ ਟੈਂਸ਼ਨ ਨਾ ਲਓ ਅੱਛਾ ਮਤਲਬ ਤੁਹਾਡਾ ਕੀ ਡਿੱਗ ਪਿਆ ਰੰਗ ਥੱਲੇ ਕਿ ਖੜਿਆ ਹਾਲੇ ਅੱਛਾ ਡਿੱਗ ਪਿਆ ਫਿਰ ਤਾਂ ਨਵਾਂ ਹੀ ਚੜ੍ਹਾਉਣਾ ਪੈਣਾ ਮਿਕਸ ਗੰਦਾ ਹੋ ਜਾਣਾ ਫਿਰ ਟਿਕਣਾ ਨਹੀਂ ਪਕੜ ਨਹੀਂ ਕਰਨੀ ਉਹਨੇ ਨਵਾਂ ਹੀ ਕਰਨਾ ਪੈਣਾ ਹਾਂਜੀ

ਹਾਂਜੀ ਨਵਾਂ ਕਲਰ ਤੁਸੀਂ ਦੱਸ ਦਿਓ ਕਲਰ ਤੁਹਾਨੂੰ ਦੱਸ ਦਾਂਗੇ ਕਿਹੜੇ ਕਿਹੜੇ ਤੁਹਾਨੂੰ ਪਸੰਦ ਆ ਦੱਸ ਦਿਓ ਹਾਂਜੀ ਬਣਾ ਦਾਂਗੇ ਹਾਂਜੀ ਖਰਚਾ ਜ਼ਿਆਦਾ ਨਹੀਂ ਆ ਉਹਦਾ ਸਸਤਾ ਅਤੇ ਹਿਸਾਬ ਕਿਤਾਬ 'ਚ ਖਰਚੇ ਦੀ ਟੈਂਸ਼ਨ ਨਾ ਲਓ ਹਾਂਜੀ ਕੋਈ ਨਾ ਚਲੋ ਉਹੀ ਕਰ ਦਾਂਗੇ ਸੈੱਟ ਫਿਰ ਦੱਸੋ ਕਲਰ ਚੋਆਇਸ ਦੱਸੋ ਕਲਰ ਕੀ ਕਿਹੜਾ ਕਲਰ ਤੁਹਾਡਾ ਪਹਿਲਾਂ ਅੱਛਾ ਕਿਹੜਾ ਕਲਰ ਸੀਗਾ ਅੱਛਾ ਅੱਛਾ ਬਰਾਊਨ ਦੁਬਾਰਾ ਬਰਾਊਨ ਸਹੀ ਹੈ ਠੀਕ ਹੈ ਜੀ ਉਹੀ ਕਰ ਦਾਂਗੇ ਠੀਕ ਹੈ ਹੋਰ ਇਹ ਅਸੀਂ ਕੱਲ੍ਹ ਬੰਦਾ ਭੇਜ ਦਾਂਗੇ ਉਹ ਸਾਰਾ ਜਾਇਜਾ ਕਰਲੂਗਾ ਉਹ ਤੁਹਾਨੂੰ ਕਲਰ ਕਲਰ ਕੋੋੋਬੀਨੇਸ਼ਨ ਦੱਸ ਦੂਗਾ ਵੀ ਕਲਰ ਤੁਹਾਨੂੰ ਕਿਹੜਾ ਪਸੰਦ ਹੈ ਸਹੀ ਲੱਗੇਗਾ ਦੁਬਾਰਾ ਥੋੜ੍ਹਾ ਬਹੁਤਾ ਮੈਚਿੰਗ ਥੋੜ੍ਹਾ ਬਹੁਤਾ ਆਪ ਵੀ ਆ ਆਵਾਂਗਾ ਨਾਲ ਬੰਦਾ ਵੀ ਆਊਗਾ ਹਾਂਜੀ ਸਰ ਹਾਂਜੀ ਅੱਛਾ ਅੱਛਾ ਹਾਂਜੀ ਹਾਂਜੀ ਨਹੀਂ ਨਹੀਂ ਨੇਰੋਲੈਕ ਹੀ ਕਰਦੇ ਹਾਂ ਅਸੀਂ ਵੀ ਨੇਰੋਲੈਕ ਸਭ ਤੋਂ ਬੈਸਟ ਕੰਪਨੀ ਹੈ ਹਾਂ ਉਹਨਾਂ ਦਾ ਹੀ ਉਹਨਾਂ ਦਾ ਹੀ ਕਰਾਂਗੇ ਹਾਂਜੀ ਨਾਲੇ ਸਾਡਾ ਅਤੇ ਹੁਣ ਤੁਹਾਡੀ ਕੋਈ ਚੀਜ਼ ਸਾਰਾ ਹਿਸਾਬ ਕਿਤਾਬ ਲਾ ਕੇ ਦੱਸਾਂ ਕਿ ਹਫ਼ਤੇ ਦਸ ਦਿਨ ਲੱਗ ਹੀ ਜਾਣਗੇ ਕਲਰ 'ਤੇ

ਹਾਂਜੀ ਹਾਂਜੀ ਸਾਰਾ ਸਮਾਨ ਕੱਢਣਾ ਪੈਣਾ ਤੁਹਾਨੂੰ

ਹਾਂਜੀ ਕੱਲ੍ਹ ਮਿਲਦੇ ਹਾਂ ਫਿਰ ਬਾਰਾਂ ਵਜੇ ਓਕੇ ਹਾਂਜੀ ਹਾਂਜੀ